ਮੌਜ਼ੂਦਾ ਦ੍ਰਿਸ਼ ਵਿੱਚ ਵਿਗਿਆਪਨ ਅਤੇ ਵਧੇਰੇ ਲੋਕਾਂ ਤੱਕ ਪਹੁੰਚਣ ਦੇ ਤਰੀਕੇ ਆਹੀ ਨੇ ਕਿ ਅਸੀਂ ਉਹਨਾਂ ਨੂੰ ਦੇਖੀਏ ਅਤੇ ਸਭ ਤੋਂ ਜ਼ਿਆਦਾ ਦਿਖਣਾ ਅੱਜ ਕੱਲ੍ਹ ਵਿਗਿਆਪਨ ਦੇ ਥਰੂ ਹੀ ਹੋ ਸਕਦਾ ਹੈ ਜਿੱਦਾਂ ਆਪਾਂ ਜਿਹੜਾ ਦਿਖਦਾ ਹੈ ਉਹੀ ਵਿਕਦਾ ਹੈ ਇਹ ਕਹਾਵਤ ਹੈਗੀ ਹੈ ਅਤੇ ਜੇ ਅਸੀਂ ਆਪਣਾ ਲੋਕਾਂ ਨੂੰ ਦਿਖਣਾ ਚਾਹੁੰਦੇ ਹਾਂ ਅਤੇ ਅਸੀਂ ਚਾਹੁੰਦੇ ਲੋਕ ਸਾਡੇ ਬਾਰੇ ਗੱਲ ਕਰਨ ਸਾਨੂੰ ਦੇਖਣ ਅਤੇ ਇਸ ਕਾਰਨ ਇਸ ਚੀਜ਼ ਲਈ ਬਹੁਤ ਸੋਸ਼ਲ ਮੀਡੀਆ ਪਲੈਟਫੋਮਸ ਅੱਜ ਕੱਲ੍ਹ ਇਹੀ ਕੰਮ ਕਰਦੇ ਨੇ ਲੋ ਤਰ੍ਹਾਂ ਤਰ੍ਹਾਂ ਦੇ ਵਿਗਿਆਪਨ ਦੇ ਤਰੀਕੇ ਹੁੰਦੇ ਨੇ ਔਰ ਅੱਜ ਕੱਲ੍ਹ ਹਰ ਐਪ ਹਰ ਬੰਦੇ ਦੇ ਹੱਥ 'ਚ ਫੋਨ ਹੈ ਅਤੇ ਅੱਜ ਕੱਲ੍ਹ ਇਸ਼ਤਿਹਾਰ ਅਸੀਂ ਬਾਹਰ ਬੋਰਡ ਦੇ ਥਰੂ ਨਹੀਂ ਲਾਉਂਦੇ ਜ਼ਿਆਦਾਤਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਲੋਕਾਂ ਨੂੰ ਫੋਨਸ 'ਚ ਦਿਖੋ ਉਹਨਾਂ ਦੇ ਹੱਥ 'ਚ ਜਿਹੜੇ ਫੋਨ ਹੈ ਉੱਥੇ ਤੁਸੀਂ ਵਾਰ ਵਾਰ ਤੁਹਾਡਾ ਵਿਗਿਆਪਨ ਜਾਵੇ ਉਹਨਾਂ ਦੀ ਨਜ਼ਰਾਂ 'ਚ ਤੁਸੀਂ ਦਿਖੋ ਇੱਕ ਬੰਦੇ ਨੂੰ ਦਿਖੇਗਾ ਅਤੇ ਉਹ ਦੂਜੇ ਨਾਲ ਗੱਲ ਕਰੇਗਾ ਇਸ ਤਰ੍ਹਾਂ ਹੀ ਤੁਸੀਂ ਦਿਖੋਗੇ ਅਤੇ ਤੁਹਾਡੇ ਬਾਰੇ ਗੱਲ ਹੋਏਗੀ ਦਿਖੋਗੇ ਤਾਂ ਵਿਕੋਗੇ ਇਹ ਹੀ ਇੱਕ ਸੱਚ ਹੈ ਅਤੇ ਇੱਦਾਂ ਇੱਦਾਂ ਦਾ ਕੋਈ ਇਸ਼ਤਿਹਾਰ ਜਿਹਦੀ ਮੈਂ ਗੱਲ ਕਰ ਸਕਦੀ ਹਾਂ ਉਹ ਹੈ ਐੱਲ ਪੀ ਯੂ ਐੱਲ ਪੀ ਯੂ ਦੀ ਮੈਂ ਐੱਲ ਪੀ ਯੂ ਤੋਂ ਪੜ੍ਹ ਰਹੀ ਹਾਂ ਮੈਨੂੰ ਵੀ ਉਹਨਾਂ ਦਾ ਇਸ਼ਤਿਹਾਰ ਦਿਖਿਆ ਸੀ ਉਹ ਵੀ ਔਨਲਾਈਨ ਔਨਲਾਈਨ ਮੈਂ ਇੰਸਟਾਗ੍ਰਾਮ ਤੋਂ ਦੇਖਿਆ ਸੀਗਾ ਅਤੇ ਮੈਂ ਇਹੀ ਕਹਿ ਸਕਦੀ ਹਾਂ ਕਿ ਮੈਨੂੰ ਉਹਨਾਂ ਦਾ ਬਹੁਤ ਅੱਛਾ ਲੱਗਿਆ ਅਤੇ ਮੈਂ ਜਾ ਕੇ ਫਿਰ ਉਹਨਾਂ ਦੀ ਜਾ ਕੇ ਰਜਿਸਟ੍ਰੇਸ਼ਨ ਕਰਾ ਲਈ ਅਤੇ ਮੈਂ ਉੱਥੇ ਐਡਮਿਸ਼ਨ ਲੈ ਲਈ ਅਤੇ ਇਹ ਇੱਕ ਬੜਾ ਵਧੀਆ ਤਰੀਕਾ ਸੀਗਾ ਕਿ ਜਿਹੜੀ ਸਾਡੇ ਵਰਗੀ ਜੋ ਅੱਜ ਕੱਲ੍ਹ ਦੀ ਜਨਤਾ ਹੈ ਜਿਹੜਾ ਫੇਸਬੁਕ ਟਵਿੱਟਰ ਇੰਸਟਾਗ੍ਰਾਮ ਤਾਂ ਹੈਗੀ ਆ ਉਹਨਾਂ ਨੂੰ ਉਹਦੇ ਥਰੂ ਹੀ ਟਾਰਗੇਟ ਕੀਤਾ ਜਾਵੇ